ਮੈਨੂੰ ਆਨਲਾਈਨ ਸ਼ੌਪਿੰਗ ਕਰਨੀ ਬਹੁਤ ਜ਼ਿਆਦਾ ਪਸੰਦ ਹੈ ਇਸ ਕਰਕੇ ਮੈਂ ਨਵੀਆਂ ਨਵੀਆਂ ਚੀਜ਼ਾਂ ਦੇਖਦੀ ਰਹਿੰਦੀ ਹਾਂ ਅਤੇ ਉਨ੍ਹਾਂ ਨੂੰ ਐਡ ਟੂ ਕਾਰਟ ਕਰਕੇ ਰੱਖ ਲੈਂਦੀ ਹਾਂ ਕਿਉਂਕਿ ਮੈਨੂੰ ਚੀਜ਼ਾਂ ਲੈਣੀਆਂ ਬਹੁਤ ਜ਼ਿਆਦਾ ਪਸੰਦ ਹਨ ਪਰ ਹੁਣ ਮੇਰੇ ਕੋਲ ਉੱਥੇ ਬਹੁਤ ਜ਼ਿਆਦਾ ਚੀਜ਼ਾਂ ਮੌਜੂਦ ਹੋ ਗਈਆਂ ਹਨ ਇਸ ਕਰਕੇ ਮੈਂ ਉਨ੍ਹਾਂ ਵਿੱਚੋਂ ਬਹੁਤ ਸਾਰੇ ਆਈਟਮਸ ਨੂੰ ਰੀਮੂਵ ਕਰ ਦਿੱਤਾ ਹੈ ਕਿਉਂਕਿ ਹੁਣ ਮੈਨੂੰ ਉਨ੍ਹਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਹੈ